ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਨਵਜੋਤ ਤੁਹਾਡੇ ਸ਼ਹਿਰ ਮਾਡਰਨ ਵੈਲੀ ਵਿੱਚ ਰਹਿਦੀ ਹਾਂ ਮੈਂ ਤੁਹਾਡੇ ਰੈਸਟੋਰੈਂਟ ਬਾਰੇ ਬਹੁਤ ਕੁਛ ਸੁਣਿਆ ਬਹੁਤ ਤਾਰੀਫ ਸੁਣੀ ਹੈ ਐਕਚੁਅਲ ਦੇ ਵਿੱਚ ਮੈਂ ਆਪਣੇ ਘਰ ਇੱਕ ਛੋਟਾ ਜਿਹਾ ਪ੍ਰੋਗਰਾਮ ਕਰਵਾ ਰਹੀ ਹਾਂ ਜਿਸ ਲਈ ਮੈਨੂੰ ਸ਼ਾਮ ਦੇ ਭੋਜਨ ਲਈ ਕੁਝ ਆਈਟਮਾਂ ਚਾਹੀਦੀਆਂ ਨੇ ਜੋ ਮੈਂ ਤੁਹਾਡੇ ਹੋਟਲ ਤੋਂ ਮੰਗਵਾਉਣਾ ਚਾਹੁੰਦੀ ਹਾਂ ਸਭ ਤੋਂ ਪਹਿਲਾਂ ਤਾਂ ਮੈਨੂੰ ਕੀ ਤੁਸੀਂ ਦੱਸ ਸਕਦੇ ਹੋ ਕਿ ਕਿਹੜੀਆਂ ਚੀਜ਼ਾਂ ਤੁਹਾਡੇ ਹੋਟਲ ਦੀਆਂ ਬਹੁਤ ਜ਼ਿਆਦਾ ਪਸੰਦ ਕੀਤੀਆਂ ਜਾਂਦੀਆਂ ਨੇ ਖਾਸ ਤੌਰ 'ਤੇ ਜੋ ਤੁਸੀਂ ਹੋਮ ਡਿਲੀਵਰੀ ਕਰ ਸਕਦੇ ਹੋ ਮੈਨੂੰ ਉਹਨਾਂ ਬਾਰੇ ਜ਼ਿਆਦਾ ਦੱਸਣਾ ਕੀ ਤੁਸੀਂ ਦੱਸ ਸਕਦੇ ਹੋ ਕਿ ਤੁਹਾਡਾ ਰੈਸਟੋਰੈਂ ਸਾਡੇ ਘਰ ਤੋਂ ਕਿੰਨੀ ਕੁ ਦੂਰੀ 'ਤੇ ਵੇ ਅਸਲ ਵਿੱਚ ਮੈਂ ਤੁਰੰਤ ਡਿਲੀਵਰੀ ਵੀ ਚਾਹੁੰਦੀ ਹਾਂ ਕੀ ਤੁਹਾਡੀਆਂ ਛੋਟਾਂ ਡਿਲੀਵਰੀ ਔਡਰਾਂ 'ਤੇ ਵੀ ਲਾਗੂ ਹੁੰਦੀਆਂ ਨੇ ਅੰਦਾਜ਼ਨ ਕਿੰਨਾ ਕੁ ਸਮਾਂ ਲੱਗੇਗਾ ਅਗਰ ਤੁਸੀਂ ਮੈਨੂੰ ਹੁਣੇ ਕੁਛ ਪਹੁੰਚਾਉਣਾ ਹੋਵੇ ਕੀ ਤੁਸੀਂ ਗਰੰਟੀ ਦਿੰਦੇ ਹੋ ਕਿ ਜਿਹੜਾ ਮੈਂ ਸਮਾਨ ਕੱਲ੍ਹ ਸ਼ਾਮ ਲਈ ਮੰਗਵਾ ਰਹੀ ਹਾਂ ਉਸ ਸਮੇਂ ਸਿਰ ਪਹੁੰਚਾ ਦਿਓਗੇ ਮੈਨੂੰ ਤੁਹਾਡੀ ਸਾਰੀ ਭੋਜਨਾਂ ਦੀ ਇੱਕ ਸੂਚੀ ਚਾਹੀਦੀ ਹੈ ਅਤੇ ਮੈਂ ਤੁਹਾਨੂੰ ਅੱਧੇ ਘੰਟੇ ਵਿੱਚ ਪੂਰੀ ਸੂਚੀ ਤਿਆਰ ਕਰਕੇ ਭੇਜ ਦੇਵਾਂਗੀ ਕਿ ਜੋ ਸਮਾਨ ਮੈਨੂੰ ਚਾਹੀਦਾ ਹੈ ਉਹ ਮੈਂ ਤੁਹਾਨੂੰ ਪੂਰਾ ਉਸ ਸੂਚੀ ਦੇ ਵਿੱਚ ਤਿਆਰ ਕਰਕੇ ਭੇਜ ਦਿੰਦੀ ਹਾਂ ਤੁਸੀਂ ਕਿਰਪਾ ਕਰਕੇ ਇਸ ਸਮਾਨ ਦੀ ਕੀਮਤ ਭੇਜ ਦੇਣਾ ਮੈਂ ਤੁਹਾਨੂੰ ਔਨਲਾਈਨ ਹੀ ਪੇ ਕਰ ਦੇਵਾਂਗੀ ਤੁਸੀਂ ਮੇਰੇ ਲਈ ਇੰਨਾ ਸਮਾਂ ਕੱਢਿਆ ਉਸ ਦੇ ਲਈ ਬਹੁਤ ਬਹੁਤ ਧੰਨਵਾਦ